ਜਿੱਥੇ ਅਸੀਂ ਰਹਿੰਦੇ ਹਾਂ ਓਥੇ ਬਹੁਤ ਸਾਰੀਆਂ ਸਥਾਨਕ ਥਾਵਾਂ ਹਨ ਜਿਸ 'ਤੇ ਸੈਲਾਨੀ ਘੁੰਮਣ ਆਉਂਦੇ ਹਨ ਇਨ੍ਹਾਂ ਨੂੰ ਟੂਰ ਗਾਈਡ ਗਾਈਡ ਕਰਦੇ ਹਨ ਅਤੇ ਹਰ ਜਗ੍ਹਾ ਦਿਖਾਉਂਦੇ ਹਨ ਜੋ ਘੁੰਮਣ ਲਈ ਬਹੁਤ ਵਧੀਆ ਹੁੰਦੀ ਹੈ ਇਨ੍ਹਾਂ ਟੂਰ ਗਾਈਡਾਂ ਨੂੰ ਬਹੁਤ ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਹੁੰਦੀ ਹੈ ਜੋ ਸੈਲਾਨੀਆਂ ਲਈ ਬਹੁਤ ਜ਼ਿਆਦਾ ਸਹਾਇਤਮੰਦ ਹੁੰਦੀ ਹੈ ਅਗਰ ਸੈਲਾਨੀ ਨੇ ਕੋਈ ਜਗ੍ਹਾ 'ਤੇ ਰਹਿਣਾ ਹੈ ਜਾਂ ਕੋਈ ਗੱਲ ਬਾਤ ਕਰਨੀ ਹੈ ਤਾਂ ਟੂਰ ਗਾਈਡ ਉਸ ਨੂੰ ਬੜੀ ਅਸਾਨੀ ਨਾਲ ਸਮਝ ਲੈਂਦੇ ਹਨ ਅਤੇ ਉਨ੍ਹਾਂ ਨੂੰ ਅੱਡ ਅੱਡ ਵੱਖ ਵੱਖ ਜਗ੍ਹਾ ਬਾਰੇ ਜਾਣਕਾਰੀ ਦੇ ਸਕਦੇ ਹਨ